ਹੈਲੋ ਸਤਿ ਸ਼੍ਰੀ ਅਕਾਲ ਜੀ ਅਮਨ ਟਰੈਲਵਰ ਟਰੈਵਲਰ ਤੋਂ ਬੋਲ ਰਹੇ ਹੈ ਸਰ ਹਾਂਜੀ ਹਾਂਜੀ ਜਿਹੜਾ ਨਾ ਤੁਸੀਂ ਆਪਣੇ ਆਪਾਂ ਨੂੰ ਡਰਾਈਵਰ ਭੇਜਿਆ ਸੀ ਜੀ ਉਹ ਵਧੀਆ ਬਹੁਤ ਸੀ ਉਹਦਾ ਨੇਚਰ ਬਹੁਤ ਵਧੀਆ ਸੀ ਜੀ ਅਤੇ ਜਿੱਥੇ ਜੀ ਮੈਨੂੰ ਛੱਡਣਾ ਸੀ ਜੀ ਉੱਥੀ ਉਹਨਾਂ ਨੇ ਮੈਨੂੰ ਉਤਾਰਿਆ ਜੀ ਅਤੇ ਜਦ ਮੈਂ ਉਹਨਾਂ ਨੂੰ ਕਿਹਾ ਵੀ ਏ ਸੀ ਔਨ ਕਰੋ ਜੀ ਉਹਨਾਂ ਨੇ ਏ ਸੀ ਕਰਿਆ ਜੀ ਕੋਈ ਫਾਲਤੂ ਗੱਲ ਨਹੀਂ ਕੀਤੀ ਉਹਨਾਂ ਨੇ ਸਾਡੇ ਨਾਲ਼ ਜੀ ਬਹੁਤ ਵਧੀਆ ਸੁਭਾਅ ਸੀ ਜੀ ਅਤੇ ਬਹੁਤ ਵਧੀਆ ਲੱਗਿਆ ਜੀ ਮੈਨੂੰ ਉਹਨਾਂ ਨਾਲ਼ ਮਿਲ ਕੇ ਜੀ ਆਪਾਂ ਇਹੋ ਜਿਹੇ ਡਰਾਈਵਰ ਵੱਧ ਤੋਂ ਵੱਧ ਰੱਖੋ ਜੀ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਇਹ ਜਿਹੇ ਡਰਾਈਵਰ ਰੱਖਣ ਨਾਲ਼ ਅਤੇ ਮੈਂ ਆਪ ਜੀ ਦਾ ਸਰ ਬਹੁਤ ਧੰਨਵਾਦ ਜੀ ਕਰਦਾ ਹਾਂ ਜੀ ਸੀ ਸਤਿ ਸ਼੍ਰੀ ਅਕਾਲ ਸਰ ਜੀ